ਹਾਂਜੀ ਆਪਣੇ ਬਾਹਰਲੇ ਦੇਸ਼ ਤੋਂ ਜਿਹੜੇ ਲੋਕ ਆਉਂਦੇ ਹਨ ਜੀ ਉਹ ਆਪਣੇ ਮੰਨ ਲਓ ਜੀ ਇੱਥੇ ਆਉਂਦੇ ਆ ਪੰਜਾਬ ਦੇ ਵਿੱਚ ਟੈਕਸੀ ਦੇ ਮੰਨ ਲਓ ਆਟੋ 'ਤੇ ਘੁੰਮਦੇ ਹਨ ਜਾਂ ਮੰਨ ਲਓ ਠੀਕ ਹੈ ਜੀ ਟੈਂਪੂ ਟਰੈਵਲਾਂ ਉੱਤੇ ਘੁੰਮਦੇ ਹਨ ਜਿਹੜੇ ਆਪਣੇ ਪੰਜਾਬ ਦੇ ਲੋਕ ਹਨ ਜੀ ਠੀਕ ਆ ਉਹ ਆਪਣੇ ਬਾਹਰ ਜਾ ਕੇ ਜਿਵੇਂ ਮਤਲਬ ਅਮੈਰੀਕਾ ਕੈਨੇਡਾ ਦੇ ਵਿੱਚ ਆ ਕੇ ਫੋਰਚੁਨਰ ਦੀਆਂ ਹੋ ਗਈਆਂ ਗੱਡੀਆਂ ਇਨੋਵਾ ਇਹੋ ਜਿਹੀਆਂ ਟੈਕਸੀਆਂ ਚੱਲਦੀਆਂ ਹਨ ਵੱਡੀਆ ਤੋਂ ਵੱਡੀਆ ਗੱਡੀਆਂ 'ਤੇ ਉੱਥੇ ਜਾ ਕੇ ਘੁੰਮਦੇ ਹਨ ਜੀ ਘੁੰਮਣ ਦੀ ਟੈਕਸੀ ਸਟੈਂਡ ਦਾ ਜੀ ਬਾਹਰਲਾ ਦੇਸ਼ ਦਾ ਬੰਦਾ ਆਉਂਦਾ ਉਹ ਸਭ ਤੋਂ ਜ਼ਿਆਦਾ ਉਹਨੂੰ ਪਤਾ ਹੁੰਦਾ ਜੀ ਆਟੋ ਵਾਲੇ ਨੂੰ ਕਿਉਂ ਉਹ ਹਰ ਜਗ੍ਹਾ ਦੇ ਵਿੱਚ ਉਹ ਗਿਆ ਹੁੰਦਾ ਹਰ ਜਗ੍ਹਾ ਦੇ ਵਿੱਚ ਗਿਆ ਹੁੰਦਾ ਉਹਨੂੰ ਪਤਾ ਹੁੰਦਾ ਦੱਸਣ ਦੀ ਤਕਰੀਬਨ ਹੀ ਆਪਾਂ ਔਰ ਉਹਨੂੰ ਮੈਪ ਕੱਢਣ ਦੀ ਲੋੜ ਨਹੀਂ ਆਪਣੇ ਆਪ ਹੀ ਆਪਾਂ ਨੂੰ ਉਹ ਜਗ੍ਹਾ ਦੇ ਕੋਲ ਲੈ ਜਾਓਗਾ ਜੀ ਜਿਹੜੀ ਵੀ ਜਗ੍ਹਾ ਦੇ ਵਿੱਚ ਚੰਗੀ ਚੰਗੀ ਜਗ੍ਹਾ ਦੇ ਵਿੱਚ ਜਾਣਾ ਜਿਵੇਂ ਦਿੱਲੀ ਦੇ ਲੈ ਲ ਲਾਲ ਕਿਲ੍ਹੇ ਦੇ ਵਿੱਚ ਘੁੰਮਣ ਜਾਣਾ ਬਾਹਰੋਂ ਆਇਆਂ ਬੰਦਾ ਉਹਨੂੰ ਨਾਲ ਦੀ ਨਾਲ ਹੀ ਲੈ ਜਾਊਗਾ ਜੀ ਦਿੱਲੀ ਉਤਰਦਿਆਂ ਸਾਰ ਹੀ ਨਾਲ ਦੀ ਨਾਲ ਉਹ ਆਪਣੇ ਟੈਕਸੀ ਦੇ ਉੱਤੇ ਚੜ੍ਹੂਗਾ ਬੈਠ ਜਾਊਗਾ ਜੀ ਆਟੋ ਵਾਲੇ ਦੇ ਨਾਲ ਅਤੇ ਜਾਊਗਾ ਜਿਵੇਂ ਆਪਣੇ ਹੁਣ ਇੱਧਰੋਂ ਪੰਜਾਬ ਦਾ ਬੰਦਾ ਜਾਂਦਾ ਹਿਮਾਚਲ ਕਸ਼ਮੀਰ ਜਾਂ ਕਿਸੇ ਵੀ ਹੋਰ ਦੇਸ਼ਾਂ ਦੇ ਵਿੱਚ ਜਾਂਦਾ ਜੀ ਉੱਥੇ ਫੋਰਚੁਨਰ ਜਿਵੇਂ ਮੰਨ ਲਓ ਜੀ ਮਲੇਸ਼ੀਆ ਦੁਬਈ ਇੱਧਰਲੇ ਦੇਸ਼ਾਂ ਦੇ ਵਿੱਚ ਤਕੜੀਆਂ ਤਕੜੀਆਂ ਮਸ਼ੀਨਾਂ ਗਾ ਜਿਹੜੀ ਵੱਡੀਆਂ ਫੋਰਚੁਨਰਾਂ ਲਈ ਉਹਨਾਂ ਦੀ ਉਹ ਟੈਕਸੀ ਸਟੈਂਡ ਚੱਲਦੀਆਂ ਹਨ